ਸਤਿ ਸ਼੍ਰੀ ਅਕਾਲ ਸਰ ਸਰ ਮੈਂ ਦੇਸ ਰਾਜ ਬੋਲਦਾ ਹੂੰ ਸਰ ਪਠਾਨਕੋਟ ਤੋਂ ਅਸੀਂ ਤੁਹਾਡੇ ਕੋਲੋਂ ਰਸ ਮਲਾਈ ਮਲਾਈ ਸੀ ਤੁਹਾਡੇ ਰੈਸਟੋਰੈਂਟ ਤੋਂ ਸਾਨੂੰ ਬਹੁਤ ਪਸੰਦ ਲੱਗੀ ਇਸ ਕਰਕੇ ਮੇਰੇ ਬੇ ਬੇਟੇ ਦਾ ਜਨਮਦਿਨ ਸੀ ਉਸ ਜਨਮਦਿਨ 'ਤੇ ਅਸੀਂ ਤੁਹਾਡੇ ਕੋਲੋਂ ਚਾਰ ਪਲੇਟ ਪਲੇਟਾਂ ਮ ਮੰਗਵਾਈ ਸੀ ਸਾਨੂੰ ਬਹੁਤ ਸਵਾਦ ਲੱਗੀ ਇਸ ਕਰਕੇ ਸਾਨੂੰ ਚਾਰ ਡੱਬੇ ਹੋਰ ਰਸ ਮਲਾਈ ਦੇ ਭੇਜੇ ਜਾਣ ਇਸ ਕਰਕੇ ਸਾਨੂੰ ਇਸ ਰੈਸਟੋਰੈਂਟ ਤੋਂ ਸਾਨੂੰ ਕੋਈ ਹੋਰ ਵਧੀਆ ਚੀਜ਼ ਪੀਜ਼ਾ ਵੀ ਭੇਜਿਆ ਜਾਵੇ ਠੀਕ ਕਿ ਨਹੀਂ ਅਤੇ ਇਸ ਕਰਕੇ ਸਾਨੂੰ ਬਹੁਤ ਪਸੰਦ ਲੱਗੀ ਹੈ ਸਾਡਾ ਅਡ ਐਡਰੈਸ ਸਾਡਾ ਐਡਰੈਸ ਹੈ ਪਿੰਡ ਭੂਰਚੱਕ ਢੇਸੀਆਂ ਦੇਸਰਾਜ